ਮੈਂ ਲੁਧਿਆਣੇ ਤੋਂ ਪੱਗ ਖਰੀਦੀ ਜੋ ਕਿ ਦੁਕਾਨਦਾਰ ਨੇ ਕਿਹਾ ਸੀ ਕਿ ਉਹ ਪੱਗ ਦਾ ਰੰਗ ਕਦੇ ਨਹੀਂ ਉਤਰੇਗਾ ਅਤੇ ਉਹ ਕੱਪੜਾ ਬਹੁਤ ਹੀ ਵਧੀਆ ਕੁਆਲਿਟੀ ਦਾ ਹੋਵੇਗਾ ਬਟ ਜਿੱਦਾਂ ਹੀ ਮੈਂ ਉਸ ਨੂੰ ਧੋਇਆ ਦੋ ਤਿੰਨ ਵਾਰ ਧੋਣ ਤੋਂ ਬਾਅਦ ਹੀ ਉਸ ਦਾ ਰੰਗ ਨਿਕਲ ਗਿਆ ਅਤੇ ਕੱਪੜਾ ਵੀ ਇੰਝ ਛਿਜ ਗਿਆ ਜਿਵੇਂ ਕਿ ਬਹੁਤ ਹੀ ਪੁਰਾਣਾ ਹੋਵੇ ਮੇਰੇ ਪੈਸੇ ਤਾਂ ਡੁੱਬੇ ਹੀ ਡੁੱਬੇ ਨਾਲ ਮੇਰੇ ਹੋਰ ਕਈ ਅਰਮਾਨ ਵੀ ਡੁੱਬ ਗਏ